ਛੱਬੀ ਜਨਵਰੀ ਦੋ ਹਜ਼ਾਰ ਵੀਹ ਪੰਦਰਾਂ ਅਗਸਤ ਦੋ ਹਜ਼ਾਰ ਤਿੰਨ ਇੱਕ ਜੁਲਾਈ ਦੋ ਹਜ਼ਾਰ ਤੇਰ੍ਹਾਂ ਵੀਹ ਅਕਤੂਬਰ ਦੋ ਹਜ਼ਾਰ ਵੀਹ ਅਠਾਰਾਂ ਅਪ੍ਰੈਲ ਉੱਨੀ ਸੌ ਤ੍ਰਿਆਨਵੇਂ